ਹੈਲੋ ਮੇਰਾ ਨਾਮ ਸੁਖਵਿੰਦਰ ਕੌਰ ਹੈ ਅਤੇ ਮੈਂ ਫਿਜੀਓਥਰੈਪੀ ਸ਼ੈਸ਼ਨਾਂ ਸੰਬੰਧੀ ਮੇਰੇ ਸਿਹਤ ਬੀਮਾ ਕਵਰੇਜ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਲਈ ਸੰਪਰਕ ਕਰ ਰਹੀ ਹਾਂ ਮੈਂ ਮੈਂ ਪੋਲਸੀ ਨੰਬਰ ਚਾਰ ਦੋ ਛੇ ਪੰਜ ਇੱਕ ਅੱਠ ਦੇ ਤਹਿਤ ਤੁਹਾਡੀ ਕੰਪਨੀ ਨਾਲ ਪੋਲਸੀ ਸੰਬੰਧੀ ਗੱਲਬਾਤ ਕਰਨਾ ਚਾਹੁੰਦੀ ਹਾਂ ਮੈਂ ਫਿਜੀ ਫਿਜੀਓਥਰੈਪੀ ਇਲਾਜ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹਾਂ ਅਤੇ ਮੇਰੀ ਯੋਜਨਾ ਦੁਆਰਾ ਪ੍ਰਦਾਨ ਕੀਤੀ ਗਈ ਕਵ ਕਵਰੇਜ ਦੀ ਸੀਮਾ ਨੂੰ ਸਮਝਣਾ ਚਾਹਾਂਗੀ ਖਾਸ ਤੌਰ 'ਤੇ ਮੈਂ ਇਹ ਪੁਸ਼ਟੀਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕੀ ਫਿਜੀਓਥਰੇਪੀ ਮੇਰੇ ਲਾਭਾਂ ਵਿੱਚ ਸ਼ਾਮਿਲ ਹੈ ਅਤੇ ਜੇਕਰ ਹਾਂ ਤਾਂ ਇਸ ਨਾਲ ਸੰਬੰਧਿਤ ਸੇਵਾਵਾਂ ਜਾਂ ਪਾਬੰਦੀਆਂ ਕੀ ਹਨ ਕੀ ਤੁਸੀਂ ਹੇਠਾਂ ਦਿੱਤੇ ਨੁਕਤਿਆਂ ਬਾਰੇ ਜਾਣਕਾਰੀ ਦੇ ਸਕਦੇ ਹੋ ਸਭ ਤੋਂ ਪਹਿਲਾਂ ਕੀ ਕਵਰ ਕਿਤੇ ਗਏ ਫਿਜੀਓਥਰੈਪੀ ਸੈਸ਼ਨਾ ਦੀ ਸਿੱਖਿਆ 'ਤੇ ਕਈ ਸੀਮਾਵਾਂ ਹਨ ਜਾਂ ਵਾਪਸ ਕੀਤੀ ਗਈ ਕੁੱਲ ਰਕਮ 'ਤੇ ਕੋਈ ਸੀਮਾ ਹੈ ਦੂਜਾ ਕਿ ਇੱਥੇ ਸਹਿ ਭੁ ਭੁਗਤਾਨ ਜਾਂ ਕਟੌਤੀਆਂ ਹਨ ਜਿਹਨਾਂ ਬਾਰੇ ਮੈਨੂੰ ਹਰੇਕ ਸੈਸ਼ਨ ਲਈ ਸੁਚੇਤ ਹੋਣ ਦੀ ਲੋੜ ਹੈ ਇਸ ਤੋਂ ਇਲਾਵਾ ਕਿ ਮੈਨੂੰ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਪ੍ਰੈਮਰੀ ਕੇਅਰ ਡਾਕਟਰ ਤੋਂ ਪੂਰਵ ਅਧਿਕਾਰ ਜਾਂ ਰੈਫਰ ਰੈਫਲਰ ਲੈਣ ਦੀ ਲੋੜ ਹੈ ਕੀ ਕੋਈ ਖ਼ਾਸ ਸਮੂਹ ਸਹੂਲਤਾਂ ਹਨ ਜੋ ਮੈਨੂੰ ਕਵਰੇਜ ਨੂੰ ਯਕੀਨੀ ਬਣਾਉਣ ਲਈ ਵਰਤੀਆਂ ਵਰਤਨੀਆਂ ਚਾਹੀਦੀਆਂ ਹਨ ਜਾਂ ਕਿ ਮੈਂ ਆਪਣਾ ਖੁਦ ਦਾ ਪਰਦਾਤਾ ਚੁਣ ਸਕਦੀ ਹਾਂ ਅੰਤ ਵਿੱਚ ਕੀ ਕੋਈ ਖ਼ਾਸ ਫਾਰਮ ਜਾਂ ਦਸਤਾਵੇਜ਼ ਹਨ ਜੋ ਮੈਨੂੰ ਅਦਾਇਗੀ ਲਈ ਜਮ੍ਹਾਂ ਜਮ੍ਹਾਂ ਕਰਨ ਦੀ ਲੋੜ ਹੈ ਅਤੇ ਦਵਾਈਆਂ ਨੂੰ ਜਮ੍ਹਾਂ ਕਰਨ ਦੀ ਪ੍ਰਕਿਰਿਆ ਕੀ ਹੈ ਇਹ ਮੈਂ ਇਹ ਯਕੀਨੀ ਬਣਾਉਣ ਲਈ ਇੱਕ ਵਿਸਤ੍ਰਿਤ ਵਿਖ ਵਿਆਖਿਆ ਦੀ ਸੰਗਲਣਾ ਕਰਨ ਕਰਾਂਗੀ ਕਿ ਮੈਂ ਸਾਰਿਆਂ ਲੋਕਾਂ ਦੀ ਪਾਲਣਾ ਕਰਦੀ ਹਾਂ ਅਤੇ ਮੇਰੇ ਲਾਭਾਂ ਨੂੰ ਵੱਧ ਤੋਂ ਵੱਧ ਕਰਦੀ ਹਾਂ ਇਸ ਮਾਮਲੇ ਵਿੱਚ ਤੁਹਾਡੀ ਸਹਾਇਤਾ ਲੈਣਾ ਚਾਹੁੰਦੀ ਹਾਂ ਕਿਰਪਾ ਕਰਕੇ ਮੈਨੂੰ ਉਪਰੋਕਤ ਮਾਮਲਿਆਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਮੈਂ ਆਪਣੇ ਇਲਾਜ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਸਕਾਂ